ਹਾਂਜੀ ਸਤਿ ਸ਼੍ਰੀ ਅਕਾਲ ਜੀ ਜੇ ਗੱਲ ਆਪਾਂ ਕਰੀਏ ਯੋਗੇ ਦੇ ਗੁਰੂਆਂ ਦੀ ਅਤੇ ਇੱਕ ਪੰਜਾਹ ਭਾਰਤ ਵਿੱਚ ਬਹੁਤ ਹੀ ਜ਼ਿਆਦਾ ਯੋਗੇ ਦੇ ਗੁਰੂ ਹਨ ਇਹਨਾਂ ਵਿੱਚੋਂ ਬਾਬਾ ਰਾਮਦੇਵ ਹਨ ਇਹਨਾਂ ਨੂੰ ਭਾਰਤ ਦਾ ਗੁਰੂ ਯੋਗੇ ਦਾ ਗੁਰੂ ਵੀ ਮੰਨਿਆ ਜਾਂਦਾ ਹੈ ਅਤੇ ਇਹ ਇਹ ਇਹਨਾਂ ਨੂੰ ਇਹਨਾਂ ਦੇ ਇਹਨਾਂ ਨੂੰ ਵੇਖ ਕੇ ਬਹੁਤ ਜ਼ਿ ਲੋਕ ਯੋਗਾ ਕਰਦੇ ਹਨ ਇਹ ਇੱਕ ਟੀ ਵੀ ਚੈਨਲ 'ਤੇ ਵੀ ਸਵੇਰ ਨੂੰ ਆਉਂਦੇ ਹਨ ਅਤੇ ਇਹ ਜਿਹੜੇ ਯੋ ਯੋਗੇ ਦੇ ਆਸਣ ਕਰਦੇ ਹਨ ਅਤੇ ਉਹ ਜੋ ਕਿ ਲੋਕ ਇਹਨਾਂ ਨੂੰ ਵੇਖ ਕੇ ਬਿਲਕੁਲ ਉਵੇਂ ਹੀ ਕਰਦੇ ਹਨ